ਪੰਜਾਬ ਜਿਹੜੀ ਹੈਗੀ ਆ ਤਿਉਹਾਰਾਂ ਦੀ ਧਰਤੀ ਹੈ ਇੱਥੇ ਲੋਕ ਸਮੇਂ ਸਮੇਂ 'ਤੇ ਕਈ ਤਰ੍ਹਾਂ ਦੇ ਤਿਉਹਾਰ ਮਨਾਉਂਦੇ ਰਹਿੰਦੇ ਆ ਸੋ ਤਿਉਹਾਰ ਜਿਹੜਾ ਹੈਗਾ ਇੱਕ ਵਧੀਆ ਤਰੀਕਾ ਹੈ ਕਿ ਮਿਲਣ ਗਿਲਣ ਦਾ ਜਾ ਖੁਸ਼ ਹੋਣ ਦਾ ਸੋ ਇਸ ਸ਼ੁਰੂਆਤ ਸਾਰਾ ਸਾਲ ਤਿਉਹਾਰ ਸਾਡੇ ਇੱਥੇ ਮਨਾਏ ਜਾਂਦੇ ਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਾਲ ਦੇ ਸ਼ੁਰੂਆਤ ਵਿੱਚ ਜਨਵਰੀ ਵਿੱਚ ਸਾਡਾ ਆ ਜਾਂਦਾ ਲੋਹੜੀ ਦਾ ਤਿਉਹਾਰ ਅਤੇ ਲੋਕ ਇਹਨੂੰ ਮਕਰ ਸੰਕ੍ਰਾਂਤੀ ਵੀ ਕਹਿੰਦੇ ਆ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਲੋਕੀਂ ਆਪਸ 'ਚ ਬੈਠ ਕੇ ਰਾਤ ਨੂੰ ਲੋਹੜੀ ਸੇਕਣੀ ਲੋਹੜੀ ਵੰਡਣੀ ਜਿਹੜੇ ਘਰ 'ਚ ਨਵਾਂ ਵਿਆਹ ਹੋਇਆ ਜਾਂ ਕਿਸੇ ਦੇ ਬੇਟਾ ਹੋਇਆ ਸੋ ਇਹ ਲੋਹੜੀ ਦਾ ਤਿਉਹਾਰ ਉਹਨਾਂ ਲਈ ਇਹ ਖੁਸ਼ੀਆਂ ਦਾ ਤਿਉਹਾਰ ਆ ਉਹ ਖੁੱਲ ਕੇ ਮਨਾਉਂਦੇ ਆ ਉਸ ਤੋਂ ਬਾਅਦ ਜੀ ਆ ਜਾਂਦਾ ਜੀ ਆਪਣਾ ਹੋਲੀ ਆ ਜਾਂਦਾ ਏ ਆ ਹੋਲੀ ਤੋਂ ਬਾਅਦ ਨਾਲ਼ ਹੀ ਇਹ ਨੈਕਸਟ ਡੇ ਸਾਡਾ ਹੋਲਾ ਮਹੱਲਾ ਏ ਆ ਸਿੱਖਾਂ ਦਾ ਖਾਸ ਤਿਉਹਾਰ ਹੈ ਇਹ ਅਤੇ ਉਹ ਤੋਂ ਬਾਅਦ ਜਿਹੜਾ ਪੰਜਾਬੀਆਂ ਦਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ ਜੀ ਸਾਡਾ ਵਿਸਾਖੀ ਉਹ ਜਿਹੜੇ ਕਿਸਾਨ ਹੈ ਆਪਣੀ ਫਸਲਾਂ ਕੱਟਣ ਦੀ ਖੁਸ਼ੀ ਵਿੱਚ ਘਰ ਆ ਜਾਣ ਦੀ ਖੁਸ਼ੀ ਵਿੱਚ ਵਿਸਾਖੀ ਮਨਾਉਂਦੇ ਆ ਅਤੇ ਇਸ ਤੋਂ ਬਾਅਦ ਫਿਰ ਸਾਡੀ ਸ਼ਿਵਰਾਤਰੀ ਆਉਂਦੀ ਹੈ ਜੀ ਉਹ ਵੀ ਅਸੀਂ ਸਾਡੇ ਹਿੰਦੂ ਪੰਜਾਬੀ ਹਿੰਦੂ ਬੜੇ ਧੂਮ ਧਾਮ ਨਾਲ਼ ਇਹਨੂੰ ਮਨਾਉਂਦੇ ਆ ਅਤੇ ਮਈ ਜੂਨ ਦੇ ਵਿੱਚ ਜਾ ਕੇ ਈਦ ਆਉਂਦੀ ਹੈ ਇਹ ਮੁਸਲਮਾਨਾਂ ਦਾ ਤਿਉਹਾਰਾਂ ਆਉਂਦਾ ਏ ਆ ਅਤੇ ਉਦੋਂ ਉਦਾਂ ਤਿਉਹਾਰ ਥੋੜ੍ਹੇ ਬਾਕੀ ਘੱਟ ਹੋ ਜਾਂਦੇ ਈਦ ਆਉਂਦੀ ਆ ਉਸ ਤੋਂ ਬਾਅਦ ਫਿਰ ਆਪਾਂ ਅਗਸਤ ਵਿੱਚ ਅਗਸਤ ਤਿਉਹਾਰ ਸ਼ੁਰੂ ਹੋ ਜਾਂਦੇ ਆ ਫਿਰ ਤਾਂ ਲਗਾਤਾਰ ਤਿਉਹਾਰ ਆਉਂਦੇ ਆ ਜਿਵੇਂ ਰੱਖੜੀ ਆ ਗਈ ਆ ਰੱਖੜੀ ਤੋਂ ਬਾਅਦ ਫਿਰ ਦੁਸ਼ਹਿਰਾ ਆ ਗਿਆ ਦੁਸ਼ਹਿਰੇ ਤੋਂ ਵੀਹ ਦਿਨ ਬਾਅਦ ਦਿਵਾਲੀ ਆ ਗਈ ਦੀਵਾਲੀ ਤੋਂ ਨੈਕਸਟ ਡੇ ਇਹ ਸਾਡਾ ਵਿਸ਼ਵਕਰਮਾ ਡੇ ਮਨਾ ਲਿਆ ਇਹ ਤੋਂ ਇਲਾਵਾ ਕਈ ਗੁਰਪੁਰਬ ਆ ਜਾਂਦੇ ਆ ਪੂਰੇ ਸਾਲ ਦੇ ਦੌਰਾਨ ਕਈ ਗੁਰਪੁਰਬ ਮਨਾਏ ਜਾਂਦੇ ਆ ਬੜੀ ਸ਼ਰਧਾ ਨਾਲ਼ ਬੜੀ ਧੂਮ ਧਾਮ ਨਾਲ਼ ਅਤੇ ਆਪਣੇ ਗੁਰੂ ਨਾਨਕ ਪੁਰਬ ਆ ਰਿਹਾ ਜੀ ਹੁਣ ਸਾਡਾ ਸਤਾਈ ਨਵੰਬਰ ਦੋ ਹਜ਼ਾਰ ਤੇਈ ਨੂੰ ਅਤੇ ਦਸੰਬਰ ਦੇ ਵਿੱਚ ਜੋ ਅਸੀਂ ਬਹੁਤ ਸ਼ਰਧਾ ਨਾਲ ਪੰਜਾਬੀ ਮਨਾਉਂਦੇ ਹਾਂ ਬੜੇ ਪੂਰੇ ਉਤਸ਼ਾਹ ਨਾਲ ਵੀ ਤਾਂ ਬੜੇ ਦੁੱਖ ਨਾਲ ਜਿਹੜਾ ਅਸੀਂ ਮਨਾਉਂਦੇ ਹਾਂ ਜਿਹੜਾ ਅਸੀਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਯਾਦ ਕਰਨ ਲਈ ਮਨਾਉਂਦੇ ਹਾਂ ਅਸੀਂ ਜੀ ਛੋਟੇ ਸਾਹਿਬਜ਼ਾਦਿਆਂ ਦੀ ਸਭਾ ਹੈਗੀ ਆ ਚਾਰ ਸਾਹਿਬਜ਼ਾਦਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਸੋ ਉਹ ਇੱਕ ਸਾਡਾ ਤਿਉਹਾਰ ਇੱਦਾਂ ਦਾ ਹੈਗਾ ਏ ਆ ਵੀ ਉਹ ਦੁੱਖ ਦਾ ਤਿਉਹਾਰ ਅਸੀਂ ਮਨਾਉਂਦੇ ਹਾਂ ਹੈ ਨਾ ਉਦੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਉਹਨਾਂ ਦੇ ਸਾਰੇ ਪਰਿਵਾਰ ਦੀ ਕੁਰਬਾਨੀ ਨੂੰ ਚੇਤਾ ਕੀਤਾ ਜਾਂਦਾ ਆ ਸੋ ਕਈ ਤਰ੍ਹਾਂ ਦੇ ਪੰਜਾਬ ਵਿੱਚ ਤਿਉਹਾਰ ਲੱਗੇ ਹੀ ਰਹਿੰਦੇ ਆ